ਸਤਿ ਸ਼੍ਰੀ ਅਕਾਲ ਮੈਂ ਔਡਰ ਕੀਤਾ ਸੀ ਜੋ ਮੈਨੂੰ ਸਹੀ ਨਹੀਂ ਪ੍ਰਾਪਤ ਹੋਇਆ ਕਿਰਪਾ ਕਰਕੇ ਮੇਰਾ ਔਡਰ ਸਹੀ ਕਰਕੇ ਭੇਜਿਆ ਜਾਵੇ ਜਾਂ ਮੇਰੇ ਸਾਰੇ ਪੈਸੇ ਵਾਪਸ ਕੀਤੇ ਜਾਣ